ਮੇਰਾ ਮਨ ਪਸੰਦ ਖੇਡ ਬੈਡਮਿੰਟਨ ਹੈ ਕਿਉਂਕਿ ਮੈਂ ਬਚਪਨ ਤੋਂ ਇਸਨੂੰ ਬਹੁਤ ਜ਼ਿਆਦਾ ਖੇਡਿਆ ਹੈ ਮੈਨੂੰ ਬਚਪਨ ਤੋਂ ਇਸ ਨੂੰ ਖੇਡਣ ਵਿੱਚ ਬਹੁਤ ਹੀ ਮਜ਼ਾ ਆਉਂਦਾ ਸੀ ਮੈਨੂੰ ਇੱਦਾਂ ਲੱਗਦਾ ਸੀ ਜਿਵੇਂ ਮੇਰੇ ਅੰਦਰ ਇੱਕ ਵੱਖਰੀ ਸਫੁਰਤਾ ਆਉਂਦੀ ਸੀ ਅਤੇ ਮੈਂ ਬਹੁਤ ਜ਼ਿਆਦਾ ਐਨਰਜੀ ਫੁੱਲ ਫੀਲ ਕਰਦੀ ਸੀ ਅਤੇ ਵੱਡੇ ਹੁੰਦੇ ਵੀ ਮੈਂ ਹੁਣ ਵੀ ਇਹ ਖੇਡ ਖੇਡਦੀ ਹਾਂ ਗਰਮੀਆਂ 'ਚ ਜਾ ਕਦੇ ਵੀ ਜਦੋਂ ਵੀ ਮਨ ਕਰਦਾ ਹੈ ਮੈਂ ਆਪਣੇ ਫਰੈਂਡਸ ਨਾਲ ਆਪਣੇ ਦੋਸਤਾਂ ਨਾਲ ਜਾਂਦੀ ਹਾਂ ਅਤੇ ਮੈਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਇੰਜੋਏ ਕਰਦੀ ਹਾਂ ਇਸ ਵਿੱਚ ਮੈਂ ਸਾਨੀਆ ਮਿਰਜ਼ਾ ਨੂੰ ਵੇਖਿਆ ਹੈ ਅਤੇ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਵੀ ਹਾਂ ਇਸ ਚੀਜ਼ ਨੇ ਮੈਨੂੰ ਬੈਡਮਿੰਟਨ ਖੇਡਦੇ ਹੀ ਮੇਰੀ ਹਾਈਟ ਬਹੁਤ ਜ਼ਿਆਦਾ ਵੱਡੀ ਵੀ ਹੋਈ ਹੈ ਮਤਲਬ ਮੈਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਲਾਭ ਹੋਇਆ ਹੈ ਸਵੇਰੇ ਸਵੇਰੇ ਖੇਡ ਕੇ ਆਉਣਾ ਦੋ ਤਿੰਨ ਘੰਟੇ ਐਨ ਉਸ ਤੋਂ ਬਾਅਦ ਤੁਹਾਡਾ ਪੂਰਾ ਦਿਨ ਇੱਦਾਂ ਨਿਕਲਦਾ ਜਿਵੇਂ ਤੁਸੀਂ ਬਹੁਤ ਹੀ ਜ਼ਿਆਦਾ ਐਨਰਜੀ ਫੁੱਲ ਹੋ ਤੁਹਾਡੇ ਅੰਦਰ ਬਹੁਤ ਜ਼ਿਆਦਾ ਐਨਰਜੀ ਹੈ ਅਤੇ ਐਨਰਜੀ ਰਾਤ ਤੱਕ ਨਹੀਂ ਖ਼ਤਮ ਹੁੰਦੀ ਅਤੇ ਅਗਲੇ ਦਿਨ ਫਿਰ ਤੁਸੀਂ ਖੇਡਣ ਜਾਂਦੇ ਹੋ ਅਤੇ ਤੁਹਾਨੂੰ ਬਹੁਤ ਹੀ ਚੰਗਾ ਲੱਗਦਾ ਹੈ ਇਸ ਵਿੱਚ ਵੀ ਅਸੀਂ ਟੀਮਸ ਬਣਾ ਕੇ ਖੇਡਦੇ ਹਾਂ ਅਤੇ ਉਸ ਤੋਂ ਹੋਰ ਵੀ ਮਜ਼ਾ ਆਉਂਦਾ ਹੈ ਅਸੀਂ ਨਾਲ ਹਾਰ ਅਤੇ ਜਿੱਤ ਵੀ ਰੱਖਦੇ ਹਾਂ ਜਿਸ ਵਿੱਚ ਸਾਨੂੰ ਹੋਰ ਜ਼ਿਆਦਾ ਖੇਡਣ ਦਾ ਮਜ਼ਾ ਆਉਂਦਾ ਕਿ ਹਾਂ ਜੇ ਅਸੀਂ ਜਿੱਤਾਂਗੇ ਤਾਂ ਸਾਨੂੰ ਚੰਗਾ ਲੱਗੇਗਾ ਅਤੇ ਇਸ ਚੀਜ਼ ਨੂੰ ਖੇਡਣ ਦੇ ਵਿੱਚ ਬਹੁਤ ਹੀ ਆਨੰਦ ਆਉਂਦਾ ਹੈ ਅਤੇ ਇਹ ਕਹਿ ਸਕਦੇ ਹਾਂ ਕਿ ਬੈਡਮਿੰਟਨ ਖੇਡਣ ਨਾਲ ਇਨਸਾਨ ਬਹੁਤ ਹੀ ਜ਼ਿਆਦਾ ਐਨਰਜੀ ਫੀਲ ਕਰਦਾ ਆਪਣੇ ਅੰਦਰ ਅਤੇ ਉਸ ਨੂੰ ਇੱਕ ਸਵੇਰੇ ਸਵੇਰੇ ਸ਼ਾਂਤੀ ਮਿਲਦੀ ਹੈ ਮਨ ਦੇ ਵਿੱਚ ਕਿ ਹਾਂ ਹੁਣ ਉਸ ਦਾ ਦਿਨ ਬਹੁਤ ਵਧੀਆ ਜਾਵੇਗਾ ਕਿਉਂਕਿ ਉਸ ਦੇ ਅੰਦਰ ਜਿਹੜੀ ਸੁਸਤੀ ਸੀ ਜਿਹੜੀ ਆਲਸ ਸੀ ਉਹ ਹੁਣ ਨਿਕਲ ਚੁੱਕੀ ਹੈ ਅਤੇ ਉਹ ਰੋਜ਼ ਖੇਡਣਾ ਪਸੰਦ ਕਰਦਾ ਹੈ ਅਤੇ ਉਸ ਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਲਾਭ ਹੁੰਦਾ ਹੈ